ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਪਛਾਣਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਮੇਰੇ ਹਿਸਾਬ ਨਾਲ ਤਾਂ ਮੇਲਾ ਦੇਵੀ ਕਾਲਰਾ ਸਕੂਲ ਠੀਕ ਹੈ ਕਿਉਂਕਿ ਉੱਥੇ ਮੈਂ ਪੜ੍ਹਾਇਆ ਹੋਇਆ ਪਹਿਲਾਂ ਅਤੇ ਤਾਂ ਮੈਨੂੰ ਪਤਾ ਉਹਦੇ ਬਾਰੇ ਹਾਂਜੀ ਹਾਂਜੀ

ਫੀਸ ਮੈ ਮੈਮ ਮੈਡਮ ਜੀ ਫੀਸ ਵੀ ਪੱਲਸ ਵਨ ਦੀ ਕੋਈ ਪੱਚੀ ਤੀਹ ਕੁ ਹਜ਼ਾਰ ਦੇ ਕਰੀਬ ਹੋਣੀ ਆ ਵਿੱਚ ਸਾਰਾ ਖਰਚਾ ਸਾਲ ਦਾ ਮੈਨੂੰ ਹੋ ਹੀ ਗਏ ਮੈਡਮ ਦਸ ਬਾਰ੍ਹਾਂ ਸਾਲ ਹਾਂ ਉਹ ਤਾਂ ਬਦਲਦਾ ਹੀ ਰਹਿੰਦਾ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਮੈਡਮ ਸਕੂਲ ਬੜੇ ਆ ਲੋਕ ਬੜੇ ਪਾਉਂਦੇ ਆ ਕਈ ਬੱਚਿਆਂ ਨੂੰ ਉੱਥੇ ਡੰਮੀ ਐਡਮਿਸ਼ਨ ਕਰਾ ਕੇ ਬਾਹਰ ਭੇਜ ਦਿੰਦੇ ਆ ਅਤੇ ਬਾਕੀ ਆਪਣੀ ਆਪਣੀ ਚੋਇਸ ਹੈ ਮੈਡਮ ਦੇਖ ਲੈਂਦੇ ਹਾਂ ਮੈਡਮ ਇੱਕ ਦੋ ਵਾਰੀ ਫਿਰ ਕਰ ਲੈਂਦੇ ਹਾਂ

ਠੀਕ ਹੈ ਤੁਸੀਂ ਦੱਸ ਦੇਣਾ ਠੀਕ ਆ ਮੈਡਮ ਠੀਕ ਆ ਜੀ ਠੀਕ ਹੈ ਮੈਡਮ ਜੀ